ਹਾਂਜੀ ਮੈਂ ਭਵਿੱਖ ਨੂੰ ਆਕਾਰ ਦੇਣ ਵਾਲੀ ਤਕਨੋਲਜੀ ਦੀ ਕਲਪਨਾ ਜਿੱਦਾਂ ਹੁਣ ਦਿਨੋ ਦਿਨ ਆਬਾਦੀ ਬਹੁਤ ਜ਼ਿਆਦਾ ਵੱਧ ਰਹੀ ਹੈ ਤਾਂ ਜੋ ਅੱਜ ਕੱਲ੍ਹ ਨਵੀਆਂ ਨਵੀਆਂ ਤਕਨੀਕਾਂ ਚੱਲ ਪਈਆਂ ਹਨ ਮੈਂ ਵੀ ਇਸ ਤਰ੍ਹਾਂ ਦਾ ਕੁਛ ਸੋਚਦੀ ਹਾਂ ਕਿ ਜਿੱਦਾਂ ਫਸਲਾਂ ਨੂੰ ਦੇ ਉਤਪਾਦਨ ਵਿੱਚ ਕੁਝ ਨਵਾਂ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਉਤਪਾਦਨ ਹੋਰ ਵਧੀਆ ਹੋ ਸਕੇ ਜਿੱਦਾਂ ਕਿ ਬਿਲਡਿੰਗਾਂ ਬਹੁਤ ਵੱਡੀਆਂ ਵੱਡੀਆਂ ਬਣ ਰਹੀਆਂ ਹਨ ਉਹਨਾਂ ਤੋਂ ਕੁਝ ਲੈ ਕੇ ਨਵੇਂ ਤਰ੍ਹਾਂ ਦੀਆਂ ਤਕਨੋਲਜੀਆਂ ਬਣਾ ਕੇ ਕੋਈ ਕੰਮ ਕਰ ਸਕੀਏ ਇਸ ਤਰ੍ਹਾਂ ਜਿੱਦਾਂ ਕਿ ਅੱਜ ਕੱਲ੍ਹ ਟੈਕਨੋਲੋਜੀ ਬਹੁਤ ਅੱਗੇ ਤੱਕ ਵੱਧ ਰਹੀ ਹੈ ਤਾਂ ਜੋ ਕੰਮਾਂ ਕਾਰਾਂ ਵਿੱਚ ਬਹੁਤ ਵਾਧਾ ਹੋ ਰਿਹਾ ਹੈ ਅਤੇ ਜਿਹੜੇ ਕਈ ਰੁਜ਼ਗਾਰ ਬੇਰੁਜ਼ਗਾਰ ਲੋਕ ਹਨ ਮੈਂ ਚਾਹੁੰਦੀ ਹਾਂ ਕਿ ਇਸ ਕਿਸ ਤਰ੍ਹਾਂ ਦਾ ਕੁਛ ਕੀਤਾ ਜਾ ਸਕੇ ਕਿ ਹਰ ਕੋਈ ਸੌਖੇ ਤਰੀਕੇ ਨਾਲ ਆਪਣਾ ਕਮਾ ਕੇ ਖਾ ਸਕੇ ਇਸ ਤਰ੍ਹਾਂ ਕੁਛ ਨਵੀਆਂ ਤਕਨੋਲਜੀਆਂ ਦੀ ਕਲਪਨਾ ਕਰਨਾ ਚਾਹੁੰਦੀ ਹਾਂ ਕਿ ਕਿਸਾਨਾਂ ਨੂੰ ਉਹਨਾਂ ਦੀ ਖੇਤੀ ਕਰਨ ਵਿੱਚ ਸਹਾਇਕ ਹੋ ਸਕੇ ਉਤਪਾਦਨ ਵਧੀਆ ਹੋ ਸਕੇ ਫਸਲ ਚੰਗੀ ਹੋਵੇਗੀ ਤਾਂ ਸਾਡਾ ਦੇਸ਼ ਆਪੇ ਹੀ ਅੱਗੇ ਵਧੇਗਾ ਕਿਸਾਨ ਵੀਰਾਂ ਨੂੰ ਵੀ ਬਹੁਤ ਵਾਧਾ ਮਿਲੇਗਾ ਜਿਹੜੇ ਕਿ ਮਿੱਟੀ ਨਾਲ ਮਿੱਟੀ ਹੁੰਦੇ ਹਨ